ਹੈਲੋ ਹਾਂਜੀ ਨਮਸਤੇ ਜੀ ਤੁਸੀਂ ਸੁਣਾਓ ਠੀਕ ਹੈ ਰਿਜਲਟ ਹੈ ਜਿੰਨਾ ਲੈਣਾ ਚਾਹੀਦਾ ਸੀ ਜਿੰਨੇ ਨੰਬਰ ਉੱਨੇ ਲਏ ਨਹੀਂ ਉਹਨੇ ਘੱਟ ਹੀ ਲਏ ਆ ਇਹਨੂੰ ਮਿਹਨਤ ਕਰਨ ਦੀ ਥੋੜ੍ਹੀ ਲੋੜ ਹੈ ਹਾਂ ਡਾਂਟ ਕੇ ਸਕੂਲ 'ਚ ਮੈਂ ਪੂਰਾ ਕੰਮ ਕਰਵਾਉਂਦੀ ਹੁਣ ਤੁਸੀਂ ਘਰ ਵੀ ਥੋੜ੍ਹਾ ਧਿਆਨ ਰੱਖਿਆ ਕਰੋ ਇਹਦਾ ਹਾਂ ਇਹਦਾ ਮੋਬਾਇਲ ਵਗੈਰਾ ਬੰਦ ਕਰੋ ਇਹਨੂੰ ਅਤੇ ਪੜ੍ਹਨ ਬਿਠਾਇਆ ਕਰੋ ਹਾਂਜੀ ਬਾਕੀ ਹਿੰਦੀ ਪੰਜਾਬੀ 'ਚੋਂ ਠੀਕ ਹੈ ਅਤੇ ਮੈਥ ਸਾਇੰਸ 'ਚੋਂ ਥੋੜ੍ਹੇ ਘੱਟ ਹੈ ਉਹਦੇ 'ਚ ਮਿਹਨਤ ਕਰਨ ਦੀ ਲੋੜ ਹੈ ਇਹਨੂੰ ਉਹ ਕਰਵਾ ਦੇਣਾ ਹਾਂਜੀ ਹੋਰ ਹੋਰ ਸ਼ਰਾਰਤਾਂ ਵੀ ਕਰਦਾ ਹੀ ਹੈ ਤਦੇ ਨੰਬਰ ਘੱਟ ਲੈਂਦਾ ਜੇ ਨਾ ਕਰੇ ਤਾਂ ਫੇਰ ਹੋਰ ਮਿਹਨਤ ਕਰੇਗਾ ਪੜ੍ਹੇਗਾ ਫੇਰ ਨੰਬਰ ਇਹਦੇ ਹੋਰ ਆ ਸਕਦੇ ਹਾਂਜੀ ਇਹਦੀ ਫਿਰ ਸੀਟ ਚੇਂਜ ਕਰ ਕੇ ਦੇਖਦੀ ਹਾਂ ਅਤੇ ਹਾਂ ਤੁਸੀਂ ਵੀ ਘਰ ਵੀ ਧਿਆਨ ਰੱਖਣਾ ਇਹਦਾ ਹਾਂਜੀ ਹਾਂਜੀ ਹਾਂਜੀ ਹਾਂਜੀ ਕੋਈ ਨਹੀਂ ਮੈਂ ਅੱਗੇ ਤੋਂ ਅੱਗੇ ਪਹਿਲੇ ਬੈਂਚ 'ਤੇ ਬਿਠਾ ਦਿਆ ਕਰਾਂਗੀ

ਹਾਂਜੀ ਟਿਊਸ਼ਨ ਦੀ ਦੇਖ ਲਓ ਜੇ ਨਹੀਂ ਘਰ ਕੋਈ ਪੜ੍ਹਾਉਣ ਵਾਲਾ ਤਾਂ ਫਿਰ ਰਖਵਾ ਦਿਓ ਜੇ ਨਹੀਂ ਬੈਠਦਾ ਤੁਹਾਡੇ ਕਹਿਣਾ ਨਹੀਂ ਮੰਨਦਾ ਤਾਂ ਹਾਂਜੀ ਹਾਂਜੀ ਹਾਂਜੀ ਫਿਰ ਰਖਵਾ ਦੇਣਾ ਹਾਂਜੀ ਠੀਕ ਹੈ ਜੀ ਫਿਰ ਹਾਂਜੀ ਓਕੇ ਬਾਏ